ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਕੋਲੋ ਪੰਦਰਾਂ ਦਿਨ ਪਹਿਲਾਂ ਕੱਪੜੇ ਮੰਗਵਾਏ ਸੀ ਉਹਨਾਂ ਦੀ ਪੈਕਿੰਗ ਵੀ ਬਹੁਤ ਅੱਛੀ ਸੀ ਅਤੇ ਸਾਈਜ ਅਤੇ ਫੀਟਿੰਗ ਵੀ ਬਹੁਤ ਅੱਛੀ ਆਈ ਅਤੇ ਕੋਆਲਟੀ ਵੀ ਬਹੁਤ ਅੱਛੀ ਸੀਗੀ ਰੇਟ ਵੀ ਬਜ਼ਾਰ ਨਾਲੋਂ ਬਹੁਤ ਸਹੀ ਸੀ ਸਮਾਨ ਬਹੁਤ ਅੱਛਾ ਅਤੇ ਪੂਰਾ ਨਿਕਲ਼ਿਆ ਅਤੇ ਬੱਚਿਆਂ ਦੇ ਪਾਉਂਣ ਵਿੱਚ ਵੀ ਬਹੁਤ ਵਧੀਆ ਆਇਆ ਅਤੇ ਮੈਨੂੰ ਤੁਹਾਡਾ ਕੱਪੜਾ ਬਹੁਤ ਪਸੰਦ ਆਇਆ ਅਤੇ ਅੱਗੇ ਨੂੰ ਵੀ ਤੁਹਾਡੇ ਕੋਲੋ ਹੀ ਮੈਂ ਮੰਗਵਾਵਾਂਗੀ ਅਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ